ਪੁਰਾਣੇ ਗੀਤਾਂ ਅਤੇ ਅੱਜ ਦੇ ਗੀਤਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਮੈਨੂੰ ਪੁਰਾਣੇ ਗੀਤ ਹੀ ਪਸੰਦ ਹੈ ਪੁਰਾਣੇ ਸਮੇਂ ਦੇ ਜਿਹੜੇ ਸੰਗੀਤਕਾਰ ਹੁੰਦੇ ਸਨ ਉਹ ਬਹੁਤ ਹੀ ਸਿੱਖੇ ਹੋਏ ਹੁੰਦੇ ਸਨ ਉਹ ਬਹੁਤ ਹੀ ਨਜ਼ਾਕਤ ਨਾਲ ਉਸ ਗੀਤ ਦੇ ਅੰਦਰ ਜਾਨ ਭਰ ਦਿੰਦੇ ਸਨ ਜਿਵੇਂ ਕਿ ਮੁਹੰਮਦ ਰਫੀ ਸਾਹਿਬ ਕਿਸ਼ੋਰ ਕੁਮਾਰ ਸਾਹਿਬ ਅਤੇ ਲਤਾ ਮੰਗੇਸ਼ਕਰ ਜੀ ਅਤੇ ਆਦਿ ਪਰ ਅੱਜ ਕੱਲ੍ਹ ਦੇ ਜੋ ਗੀਤ ਨੇ ਉਹਨਾਂ 'ਚ ਅਸ਼ਲੀਲਤਾ ਵੀ ਬਹੁਤ ਹੈ ਉਹਨਾਂ 'ਚ ਦਿਖਾਵਾ ਬਹੁਤ ਕੀਤਾ ਜਾਂਦਾ ਹੈ ਕਿ ਮੇਰੇ ਕੋਲ ਬਹੁਤ ਪੈਸਾ ਹੈ ਮੈਂ ਪੁਲਿਸ ਨੂੰ ਆਪਣੇ ਥੱਲੇ ਰੱਖਦਾ ਕੁਛ ਇੱਦਾਂ ਦੇ ਬਹੁਤ ਸਾਰੇ ਗੀਤ ਤੁਹਾਨੂੰ ਅੱਜ ਕੱਲ੍ਹ ਦੇ ਮਿਲ ਜਾਣਗੇ ਜੋ ਕਿ ਬਹੁਤ ਹੀ ਜ਼ਿਆਦਾ ਭੜਕਾਊ ਗੀਤ ਹੁੰਦੇ ਹਨ ਅਤੇ ਜਿਹੜੇ ਅੱਜ ਕੱਲ੍ਹ ਦੇ ਸਿੰਗਰ ਵੀ ਹੁੰਦੇ ਹਨ ਉਹ ਵੀ ਇੰਨੇ ਸਿੱਖੇ ਨਹੀਂ ਹੁੰਦੇ ਹਨ ਉਹ ਸਿਰਫ ਜਿਵੇਂ ਅੱਜ ਕੱਲ੍ਹ ਤੱਕ ਤਕ ਤੈਕਨੋਲੋਜੀ ਇੰਨੀ ਵੱਧ ਰਹੀ ਹੈ ਕਿ ਜਦੋਂ ਗੀਤ ਰਿਕਾਰਡ ਹੁੰਦੇ ਹਨ ਅਤੇ ਉਹ ਜਿੱਦਾਂ ਦਾ ਵੀ ਮਰਜ਼ੀ ਗਾਣ ਪਰ ਕੰਪਿਊਟਰ ਤੋਂ ਉਸ ਆਵਾਜ਼ ਨੂੰ ਸੁਰੀਲਾ ਬਣਾ ਦਿੱਤਾ ਜਾਂਦਾ ਹੈ ਜਿਹਨੂੰ ਆਟੋ ਟਿਊਨ ਕਹਿੰਦੇ ਹਾਂ ਅਸੀਂ ਅੰਗਰੇਜ਼ੀ ਦੇ ਵਿੱਚ ਪਰ ਪੁਰਾਣੇ ਟਾਈਮ 'ਤੇ ਇੱਕ ਇੱਕ ਸਿੰਗਰ ਨੂੰ ਉਸ ਗੀਤ ਦੇ ਉੱਪਰ ਇੰਨਾਂ ਕੰਮ ਕਰਨਾ ਪੈਂਦਾ ਸੀ ਅਤੇ ਇੱਕੋ ਵਾਰੀ ਹੀ ਪੂਰਾ ਦਾ ਪੂਰਾ ਗੀਤ ਰਿਕਾਰਡ ਕਰਨਾ ਪੈਂਦਾ ਸੀਗਾ ਅਤੇ ਅਗਰ ਤੁਸੀਂ ਪੁਰਾਣੇ ਗੀਤ ਵੀ ਸੁਣੋਗੇ ਉਹਨਾਂ 'ਚ ਭਾਵ ਬਹੁਤ ਹੁੰਦਾ ਹੈ ਉਹ ਸੁਣ ਕੇ ਤੁਹਾਡੇ ਅੰਦਰ ਆਪਣੇ ਆਪ ਤੁਹਾਡੇ ਚਿਹਰੇ 'ਤੇ ਆਪਣੇ ਆਪ ਮੁਸਕਰਾਹਟ ਆ ਜਾਂਦੀ ਹੈ ਪਰ ਅੱਜ ਕੱਲ੍ਹ ਦੇ ਕੁਝ ਗੀਤ ਕੁਛ ਵੀ ਨਹੀਂ ਜ਼ਿਆਦਾਤਰ ਗੀਤ ਜ਼ਿਆਦਾਤਰ ਗੀਤ ਅੱਜ ਕੱਲ੍ਹ ਦੇ ਬਹੁਤ ਹੀ ਭੜਕਾਊ ਬਣ ਚੁੱਕੇ ਹਨ ਇਹਨਾਂ 'ਚ ਬੰਦੂਕਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਲੜਾਈਆਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤੇ ਇਹ ਫਰਕ ਹੈ ਪੁਰਾਣੇ ਗੀਤਾਂ 'ਚ ਅਤੇ ਨਵੇਂ ਗੀਤਾਂ 'ਚ ਅੱਜ ਕੱਲ੍ਹ ਦੇ ਗੀਤਾਂ 'ਚ ਪਰ ਮੈਨੂੰ ਹਮੇਸ਼ਾ ਪੁਰਾਣੇ ਗੀਤ ਹੀ ਪਸੰਦ ਰਹਿਣਗੇ